ਮੇਰੇ ਪਰਿਵਾਰ ਵਿੱਚ ਮੇਰੇ ਪਿਤਾ ਮਾਤਾ ਮੇਰਾ ਭਾਈ ਬ ਭਾਬੀ ਸਾਰੇ ਚਾਚਾ ਚਾਚੀ ਮਾਸੀ ਮਾਸੜ ਫੁੱਫੜ ਭੂਆ ਨਾਨਾ ਨਾਨੀ ਤਾਇਆ ਤਾਈ ਮੇਰਾ ਛੋਟਾ ਭਾਈ ਭਤੀਜਾ ਇਹ ਸਾਰੇ ਹਨ ਅਤੇ ਅਸੀਂ ਬਹੁਤ ਖੁਸ਼ ਹਨ ਸਾਡੇ ਜਿਹੜੇ ਮੇਰੇ ਦੋਸਤ ਮੈਂ ਜਿੱਦਾਂ ਮੇਰੇ ਘਰਦਿਆਂ ਨੇ ਮੈਨੂੰ ਸਾਡੇ ਛੋਟੇ ਹੁੰਦੇ ਸਾਨੂੰ ਜਿੱਦਾਂ ਸਕੂਲ ਤਾਂ ਲਾ ਤਾ ਲਾਉਣ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਉਮਰ ਹੁੰਦੀ ਗਈ ਅਤੇ ਦੋਸਤ ਬਣਦੇ ਰਹੇ ਉਹ ਵੀ ਇੱਕ ਅਲੱਗ ਟਾਇਮ ਸੀ ਪੀਰੀਅਡ ਬਹੁਤ ਵਧੀਆ ਦੋਸਤ ਰਹੇ ਅੱਜ ਵੀ ਅਸੀਂ ਮਿਲਦੇ ਵਰਤਦੇ ਹਾਂ ਕੁਝ ਪੁਰਾਣੇ ਵੀ ਹੈ ਕੁਝ ਨਵੇਂ ਵੀ ਬਣੇ ਗਹਾਂ ਹੋਰ ਬਣਨਗੇ ਇਹ ਸਰਕਲ ਚੱਲਿਆ ਰਹਿਣਾ ਆ ਜਿੱਦਾਂ ਵੀ ਹੈ ਬਹੁਤ ਖੁਸ਼ ਹੈ ਅਸੀਂ ਅਸੀਂ ਬੈਠਦੇ ਇਕੱਠੇ ਵੀ ਹਾਂ ਖਾਂਦੇ ਪੀਂਦੇ ਵੀ ਹਾਂ ਪਾਰਟੀ ਵੀ ਕਰਦੇ ਹਾਂ ਇੰਨਜੋਏਮੈਂਟ ਕਰਦੇ ਹਾਂ ਫੰਕਸ਼ਨ ਅਟੈਂਡ ਕਰਦੇ ਹਾਂ ਮੈਰਿਜ ਮੈਰਿਜ ਫੰਕਸ਼ਨ ਅਟੈਂਡ ਕਰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਮਸਤ ਹੀ ਰਹਿੰਦੇ ਹਾਂ ਕਦੇ ਕਿਤੇ ਘੁੰਮਣ ਜਾਣਾ ਅਸੀਂ ਪਰਿਵਾਰ 'ਚ ਵੀ ਮੇਨ ਰੱਖਿਆ ਵੀ ਕਿ ਜੇ ਪਰਿਵਾਰ ਨਾਲ਼ ਸੱਭਿਆਚਾਰਕ ਤੌਰ 'ਤੇ ਗੱਲ ਬਾਤ ਹੁੰਦੀ ਆ ਉਹਨਾਂ ਦੀ ਪਰਿਵਾਰ ਨਾਲ਼ ਸਾਡਾ ਬਹੁਤ ਪਿਆਰ ਹੈ ਸਾਂਝਾ ਪਰਿਵਾਰ ਹੁੰਦਾ ਹੈ ਅਤੇ ਅਸੀਂ ਜਿੱਦਾਂ ਵੀ ਆ ਖੁਸ਼ ਰਹਿੰਦੇ ਹਾਂ ਆਪਸ 'ਚ ਅਤੇ ਸ਼ਾਮ ਨੂੰ ਜਦੋਂ ਪਿੰਡ ਆਉਂਦੇ ਜਿੱਦਾਂ ਮੰਨ ਲਉ ਜਾਂ ਸ਼ਹਿਰ ਆਉਂਦੇ ਜਾਂ ਸੀਟੀ ਆਉਂਦੇ ਹੁਣ ਮੈਂ ਤਾਂ ਪਿੰਡ 'ਚ ਰਹਿਣ ਵਾਲਾ ਹਾਂ ਅਤੇ ਸ਼ਾਮ ਨੂੰ ਅਸੀਂ ਇਕੱਠੇ ਹੋ ਕੇ ਸੜਕਾਂ 'ਚ ਘੁੰਮਣ ਜਾਂਦੇ ਹਾਂ ਵੋਕ 'ਤੇ ਨਿਕਲਦੇ ਹਾਂ ਫਿਰ ਅਸੀਂ ਕੰਮ ਕ ਕੰਮ 'ਤੇ ਵੀ ਸਾਡੇ ਨਵੇਂ ਦੋਸਤ ਬਣਦੇ ਆ ਜੋ ਕਿ ਸਾਡੇ ਘ ਘਰ ਪਰਿਵਾਰ ਵਿੱਚ ਵੀ ਆਉਂਦੇ ਆ ਸਮ ਕਿ ਨਿਊ ਨਿਊ ਜਿਹੜੇ ਫ੍ਰੈਂਡ ਬਣਦੇ ਆ ਬੜੇ ਵਧੀਆ ਆ ਪਰ ਪੁਰਾਣੇ ਫ੍ਰੈਂਡਾਂ ਦੀ ਵੀ ਯਾਦ ਆਉਂਦੀ ਹੈ ਜਿਹੜੇ ਸਕੂਲ 'ਚ ਇੱਕ ਟਾਈਮ ਕਈ ਬੋਲਦੇ ਕਈ ਨਹੀਂ ਬੋਲਦੇ ਹੈ ਪਰ ਜ਼ਿਆਦਾਤਰ ਤਾਂ ਬੋਲਦੇ ਹੀ ਆ ਪਰ ਜਿਹੜੇ ਦੂਰ ਚਲੇ ਗਏ ਫੌਰਨ ਕੰਨਟਰੀ ਮ ਨਿਕਲ ਗਏ ਪਰ ਜਿਹੜੇ ਨੇੜੇ ਆ ਉਹ ਹਲੇ ਵੀ ਬੋਲਦੇ ਆ ਅਤੇ ਅਸੀਂ ਤਾਂ ਇਹੀ ਅਪੀਲ ਕਰਾਂਗੇ ਵੀ ਗਾਹਾਂ ਤੋਂ ਗਾਹਾਂ ਸਾਨੂੰ ਸਾਡੀ ਦੋਸਤੀ ਹੋਰ ਵਧੇ ਸਾਡਾ ਪ ਪਰਿਵਾਰ ਪੂਰ ਵਧੇ ਸਾਰਿਆਂ ਖੁਸ਼ ਰਹਿਣ ਦੋਸਤ ਯਾਰੀ ਖੁਸ਼ਹਾਲ ਰਹਿਣ ਰਿਸ਼ਤੇਦਾਰੀ ਬਖ਼ਸੇ